ਹੈਲੋ ਹਾਂਜੀ ਸਰ ਸਰ ਮੈਂ ਆਪਣਾ ਕੈਬ ਬੁੱਕ ਕਰਵਾਉਣੀ ਸੀਗੀ ਤੁਹਾਡੇ ਤੋਂ ਤੁਸੀਂ ਆਪਣਾ ਕੈਬ ਬੁੱਕ ਕਰਦੇ ਹੋ ਮੈਂ ਮਤਲਬ ਜਾਣਾ ਸੀਗਾ ਕਿਤੇ ਅਤੇ ਮੈਨੂੰ ਪਤਾ ਲੱਗਿਆ ਸੀਗਾ ਕਿ ਤੁਸੀਂ ਕੈਬ ਦੀ ਬੁਕਿੰਗ ਕਰਦੇ ਹੋ ਅਤੇ ਕੀ ਮੇਰੇ ਕੁਛ ਐਡਰੈਸ ਹੈ ਮੇਰਾ ਮੈਂ ਉਹਨੂੰ ਉਹਦੀ ਲੋਕੇਸ਼ਨ ਤੁਹਾਨੂੰ ਸੈਂਡ ਕਰਦਾ ਹਾਂ ਅਤੇ ਉੱਥੋਂ ਦੀ ਦੇਖੋਗੇ ਕੋਈ ਅਗਰ ਤੁਹਾਡਾ ਕੋਈ ਉੱਥੇ ਲਾਗੇ ਕੋਈ ਕੈਬ ਹੈ ਤਾਂ ਉਸ ਨੂੰ ਮੈਨੂੰ ਮੇਰੇ ਕੋਲ ਭੇਜ ਦਿਓ ਮੈਂ ਆਪਣਾ ਇੱਥੋਂ ਤਰਨਤਾਰਨ ਜਾਣਾ ਹੈ ਅਤੇ ਉੱਥੇ ਆਪਣਾ ਜਾ ਕੇ ਅਤੇ ਉੱਥੋਂ ਤੱਕ ਦਾ ਮੈਨੂੰ ਪੁੱਛਣਾ ਸੀਗਾ ਕਿ ਕ ਤੁਹਾਡੇ ਕੋਲ ਕੋਈ ਫੋਰ ਵੀਲਰ ਕੋਈ ਆਪਣਾ ਚਾਰ ਸੀਟਾਂ ਵਾਲੀ ਕੋਈ ਗੱਡੀ ਹੈਗੀ ਹੈਗੀ ਤੋ ਤੁਸੀਂ ਉਹਨੂੰ ਮੈਨੂੰ ਭੇਜੋ ਅਤੇ ਮੈਨੂੰ ਦੱਸੋ ਕਿ ਉਸ ਦਾ ਕੀ ਕਿਰਾਇਆ ਹੋਵੇਗਾ ਅਤੇ ਹਾਂ ਉਹਦਾ ਜੋ ਵੀ ਉਹਦਾ ਆਉਣ ਜਾਣ ਦਾ ਕਿਰਾਇਆ ਬਣੇਗਾ ਤਾਂ ਉਹ ਮੈਂ ਆਪਣਾ ਉਹ ਆਪਣਾ ਦੇਣ ਨੂੰ ਤਿਆਰ ਹੈਗਾ ਹਾਂ ਅਤੇ ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹ ਜਿਹੜੀ ਹੈਗੀ ਹੈਗੀ ਇਹ ਕੈਬ ਹੈ ਉਹ ਮੈਨੂੰ ਕਦੋਂ ਤੱਕ ਮਿਲ ਸਕਦੀ ਇਹਦੀ ਸਰਵਿਸ ਔਰ ਔਰ ਇਹ ਕਦੋਂ ਤੱਕ ਆਪਣਾ ਆ ਜਾਵੇਗੀ ਮੇਰੇ ਕੋਲ ਅਤੇ ਇੱਥੋਂ ਤੁਸੀਂ ਮੈਨੂੰ ਮੇਰੇ ਕੋਲ ਭੇਜਣ ਦੀ ਕਿਰਪਾ ਕਰਿਓ ਜੀ